ਮੈਂ ਉਦੋਂ ਹੀ ਲਿਖਣਾ ਸ਼ੁਰੂ ਕਰਦੀ ਹਾਂ ਜਦੋਂ ਕਿ ਮੇਰੇ ਦਿਮਾਗ ਵਿੱਚ ਕੋਈ ਵਿਚਾਰ ਹੁੰਦੇ ਹਨ ਪਹਿਲਾਂ ਮੈਂ ਉਹਨਾਂ ਵਿਚਾਰਾਂ ਨੂੰ ਰਫ਼ ਤੌਰ 'ਤੇ ਪੇਜ 'ਤੇ ਜਾਂ ਫੋਨ 'ਤੇ ਉਤਾਰਦੀ ਹਾਂ ਉਸ ਤੋਂ ਬਾਅਦ ਮੈਂ ਉਸ ਵਿੱਚ ਥੋੜ੍ਹੀ ਥੋੜ੍ਹੀ ਸੋਧ ਕਰਕੇ ਉਸ ਨੂੰ ਇੱਕ ਪੂਰਾ ਚੰਗੀ ਤਰ੍ਹਾਂ ਫਾਈਨਲ ਰੂਪ ਦਿੰਦੀ ਹਾਂ ਇਹ ਕੋਈ ਡਰਾਫਟ ਬਣਾਉਣ ਦੀ ਮੇਰੀ ਕੋਈ ਗਿਣਤੀ ਨਹੀਂ ਹੈ ਮੈਂ ਜਿੰਨੇ ਤੱਕ ਉਹ ਕਵਿਤਾ ਜਾਂ ਕੁਛ ਵੀ ਲਿਖਿਆ ਹੋਇਆ ਪੂਰੀ ਤਰ੍ਹਾਂ ਸਹੀ ਨਹੀਂ ਹੁੰਦਾ ਉਨੀ ਵਾਰ ਉਸ ਵਿੱਚ ਸੋਧ ਕਰਦੀ ਹਾਂ ਮੈਂ ਕਦੇ ਵੀ ਗਿਣ ਕੇ ਇਹ ਕੰਮ ਨਹੀਂ ਕਰਦੀ ਸਭ ਪ੍ਰਮਾਣਿਕਤਾ ਲੈਣ ਲਈ ਮੈਂ ਸਭ ਤੋਂ ਵੱਧ ਆਪਣੇ ਦੋਸਤਾਂ ਵੱਲ ਜਾਂਦੀ ਹਾਂ ਮੈਂ ਆਪਣੇ ਦੋਸਤਾਂ ਤੋਂ ਆਪਣੀ ਲਿਖਾਈ ਬਾਰੇ ਜਾਣਕਾਰੀ ਲੈਂਦੀ ਹਾਂ ਅਤੇ ਉਹਨਾਂ ਦੀ ਰਾਏ ਲੈਂਦੀ ਹਾਂ ਉਹ ਮੈਨੂੰ ਦੱਸ ਦਿੰਦੇ ਹਨ ਕਿ ਇਸ ਵਿੱਚ ਜੇ ਕੋਈ ਕਮੀ ਹੈ ਤਾਂ ਤੁਸੀਂ ਕਿਸ ਤਰ੍ਹਾਂ ਸੁਧਾਰ ਕਰ ਸਕਦੇ ਹੋ ਮੈਂ ਲਿਖਣ ਵੇਲੇ ਵੀ ਆਪਣੇ ਦੋਸਤਾਂ ਦੀ ਹੀ ਸਲਾਹ ਲੈਂਦੀ ਹਾਂ ਉਹ ਮੈਨੂੰ ਵੱਖ ਵੱਖ ਵਿਸ਼ਿਆਂ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹਨ ਜਿਸ ਉੱਤੇ ਕਿ ਮੈਂ ਲਿਖ ਸਕਦੀ ਹਾਂ ਉਹੀ ਮੇਰਾ ਉਤਸ਼ਾਹ ਵਧਾਉਂਦੇ ਹਨ ਇਸ ਲਈ ਹੀ ਮੈਂ ਉਹਨਾਂ ਦੀ ਹੀ ਸਲਾਹ ਲੈਣਾ ਪਸੰਦ ਕਰਦੀ ਹਾਂ